ਡਾਂਸਰਾਂ ਨੂੰ ਆਮ ਤੌਰ 'ਤੇ ਪੈਰਾਂ ਅਤੇ ਗਿੱਟੇ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਵੇਂ ਕਿ ਗਿੱਟੇ ਦੀ ਮੋਚ ਤਣਾਅ ਦੇ ਭੰਜਨ ਅਤੇ ਤਿਲ ਦੀਆਂ ਸੱਟਾਂ ਡਾਂਸਰਾਂ ਨੂੰ ਜਿਹਨਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹਨਾਂ ਵਿੱਚ ਸਰੀਰਕ ਸੱਟਾਂ ਮਨੋਵਿਗਿਆਨਿਕ ਤਣਾਅ ਭੂਮਿਕਾਵਾਂ ਲਈ ਮੁਕਾਬਲਾ ਭਾਰ ਪ੍ਰਬੰਧਨ ਦੇ ਮੁੱਦੇ ਅਤੇ ਸਮਾਜਿਕ ਰੂੜੀਵਾਦ ਸ਼ਾਮਲ ਹਨ ਮਹਿਲਾ ਡਾਂਸਰਾਂ ਨੂੰ ਧੱਕੇਸ਼ਾਹੀ ਦਾ ਸਾਹਮਣਾ ਕਰਨਾ ਪੈਂਦਾ ਹੈ ਮਾਨਤਾ ਬਜ਼ੁਰਗ ਔਰਤਾਂ ਦੁਆਰਾ ਅਤੇ ਉਹਨਾਂ ਲਈ ਬਣਾਏ ਗਏ ਡਾਂਸਰਾਂ ਨੂੰ ਉਹ ਮਾਨਤਾ ਪ੍ਰਾਪਤ ਨਹੀਂ ਹੋ ਸਕਦੀ ਜਿਸ ਦੀ ਉਹ ਹੱਕਦਾਰ ਹਨ ਇਸ ਲਈ ਸਮਾਜ ਵਿੱਚ ਡਾਂਸਰਾਂ ਨੂੰ ਇੱਜ਼ਤ ਨਹੀਂ ਦਿੱਤੀ ਜਾਂਦੀ ਉਹਨਾਂ ਨੂੰ ਮਜ਼ਬੂਰੀ ਵਿੱਚ ਡਾਂਸ ਕਰਨਾ ਪੈਂਦਾ ਹੈ ਪਰ ਲੋਕ ਉਹਨਾਂ ਦੀ ਮਜ਼ਬੂਰੀ ਨਹੀਂ ਸਮਝਦੇ ਅਤੇ ਉਹਨਾਂ ਨਾਲ ਬਦਤਮੀਜੀ ਬਦਸਲੂਕੀ ਕਰਦੇ ਹਨ ਇਹਨਾਂ ਨੂੰ ਸਮਾਜ ਵਿੱਚ ਬਰਾਬਰ ਇੱਜ਼ਤ ਨਹੀਂ ਦਿੱਤੀ ਜਾਂਦੀ ਇਹਨਾਂ ਨੂੰ ਲੋਕ ਬੁਰੀਆਂ ਨਜ਼ਰਾਂ ਨਾਲ ਵੇਖਦੇ ਹਨ ਕਈ ਲੋਕ ਇਹਨਾਂ ਦੀ ਮਜ਼ਬੂਰੀ ਦਾ ਫਾਇਦਾ ਚੁੱਕਦੇ ਹਨ ਇਹਨਾਂ ਦਾ ਵੀ ਜੀਅ ਨਹੀਂ ਕਰਦਾ ਇਹ ਕੰਮ ਕਰਨ ਨੂੰ ਪਰ ਇਹਨਾਂ ਨੂੰ ਮਜ਼ਬੂਰੀ ਵਿੱਚ ਇਹ ਕੰਮ ਕਰਨਾ ਪੈਂਦਾ ਹੈ ਸਾਡੇ ਸਮਾਜ ਵਿੱਚ ਡਾਂਸਰਾਂ ਨੂੰ ਬਿਲਕੁਲ ਵੀ ਇੱਜ਼ਤ ਨਹੀਂ ਦਿੱਤੀ ਜਾਂਦੀ ਇਹਨਾਂ ਨੂੰ ਮਰਦਾਂ ਦੇ ਬਰਾਬਰ ਨਹੀਂ ਸਮਝਿਆ ਜਾਂਦਾ ਲੋਕ ਇਹਨਾਂ ਵੱਲ ਬਹੁਤ ਬੁਰੀ ਨਜ਼ਰ ਨਾਲ ਵੇਖਦੇ ਹਨ ਅਤੇ ਇਹਨਾਂ ਦੀ ਇੱਜ਼ਤ ਨਹੀਂ ਕਰਦੇ ਇਸ ਕਰਕੇ ਸਮਾਜ ਵਿੱਚ ਇਹਨਾਂ ਨੂੰ ਵੀ ਵਿਚਰਨ ਦਾ ਪੂਰਾ ਪੂਰਾ ਹੱਕ ਹੈ